ਪੰਜਾਬ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਉਹਦੇ ਵਿੱਚ ਕਾਫੀ ਕਮੀਆਂ ਕਹੀਆਂ ਜਾ ਸਕਦੀਆਂ ਨੇ ਹਰ ਵਿਦਿਆਰਥੀ ਨੂੰ ਸਿੱਖਿਆ ਦੇ ਨਾਲ ਨਾਲ ਪ੍ਰੈਕਟੀਕਲ ਸਿੱਖਿਆ ਜਿਹੜੀ ਉਹ ਦੇਣੀ ਜ਼ਰੂਰੀ ਹੈ ਕਿਉਂਕਿ ਬੱਚੇ ਜੇ ਦਸਵੀਂ ਤੋਂ ਬਾਅਦ ਜਾਂ ਬਾਰਵੀਂ ਤੋਂ ਬਾਅਦ ਜਾਂ ਗ੍ਰੈਜੂਏਸ਼ਨ ਕਿਸੇ ਵੀ ਲੈਵਲ 'ਤੇ ਜਦੋਂ ਉਹ ਬਾਹਰ ਨਿਕਲਣ ਅਤੇ ਉਹਨਾਂ ਦੇ ਕੋਲ ਹੱਥ ਵਿੱਚ ਐਸੀ ਸਿੱਖਿਆ ਹੋਣੀ ਚਾਹੀਦੀ ਹੈ ਵੀ ਜੇ ਉਹ ਬਾਹਰ ਨਿਕਲਦੇ ਨੇ ਤਾਂ ਉਹ ਨਾਲ ਦੀ ਨਾਲ ਆਪਣੀ ਕੋਈ ਕਿਰਤ ਕਰਕੇ ਆਪਣਾ ਪੇਟ ਭਰ ਸਕਣ ਜੋ ਇਹ ਸਾਡੀ ਸਿੱਖਿਆ ਦੇ ਵਿੱਚ ਹਾਲੇ ਤੱਕ ਇਹ ਗੱਲਾਂ ਸ਼ਾਮਿਲ ਨਹੀਂ ਹੋਈਆਂ ਇਸ ਵੱਲ ਸਰਕਾਰ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਬੱਚੇ ਵਿਕਾਸ ਕਰ ਸਕਣ ਅੰਤਰਰਾਸ਼ਟਰੀ ਕੰਪਨੀਜ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਿੱਖਿਆ ਦੇ ਕੇ ਬੱਚਿਆਂ ਨੂੰ ਆਪਣੀ ਕਿਰਤ ਕਰਨ ਦੇ ਲਈ ਤਿਆਰ ਕਰਨਾ ਚਾਹੀਦਾ